ਹਾਂਜੀ ਵੀਰ ਸਤਿ ਸ਼੍ਰੀ ਅਕਾਲ ਜੀ ਵੀਰ ਮੈਂ ਮੇਰੇ ਬੜੇ ਭਾਈ ਨੇ ਤੁਹਾਡਾ ਨੰਬਰ ਦਿਆ ਸੀਗਾ ਮੈਂ ਉਰੇ ਐਡਮੀਸ਼ਨ ਲਈ ਹੈ ਜੀ ਛੇ ਫੇਜ ਮੋਹਾਲੀ ਫਸਟ ਈਅਰ 'ਚ ਇਹਦੇ ਵੀਰ ਵੀ ਪੁੱਛਣਾ ਸੀਗਾ ਮੈਂ ਉ ਆਉਣਾ ਤਾਂ ਇੱਧਰੋਂ ਸ਼ਿਫਟ ਕਰਨਾ ਸੀ ਇੱਧਰ ਮੌਸਮ ਕਿਕਣਾ ਸਾਡੇ ਕਨੀ ਤਾਂ ਮੌਸਮ ਕਾਫੀ ਖਰਾਬ ਸੀਗਾ ਅੱਛਾ ਜੀ ਅਤੇ ਉਰੇ ਅੱਛਾ ਅਤੇ ਅੱਛਾ ਅਤੇ ਸਰਦੀਆਂ ਵਿੱਚ ਕਿਕਣਾ ਰਹਿੰਦਾ ਜੀ ਉਰੇ ਅੱਛਾ ਅਤੇ ਉਰੇ ਰਹਿਣ ਰੂਣ ਦਾ ਵੀਰ ਕਿਵੇਂ ਹੈ ਉਰੇ ਪੀਜੀ ਪੁਜੀ ਦਾ ਸਿਸਟਮ ਉਰੇ ਕਾਲਜ ਦੇ ਕੋਲਜ ਦੇ ਨੇੜੇ ਹੀ ਮਿਲ ਜਾਂਦਾ ਅਤੇ ਬਹੁਤਾ ਦੂਰ ਤਾਂ ਨਹੀਂ ਹੈਗਾ ਜੀ ਕਾਫੀ ਦੂਰ ਤੋਂ ਤੁਰ ਕੇ ਆਉਣਾ ਪੈਂਦਾ ਹੋਵੇ ਅੱਛਾ ਜੀ ਅਤੇ ਉਰੇ ਖਾਣੇ ਖੁਣੇ ਦਾ ਵਧੀਆ ਮਿਲ ਜਾਂਦਾ ਜੀ ਉਰੇ ਅਤੇ ਉਰੇ ਊਂ ਵੈਸੇ ਬਰਸਾਤਾਂ ਵਿੱਚ ਮੌਸਮ ਠੀਕ ਰਹਿੰਦਾ ਜੀ ਉਰੇ ਦਾ ਟਰਾਂਪੋਟੇਸ਼ਨ ਫਿਰ ਰੇਡੀ ਹੈਗੀ ਉਰੇ ਵਧੀਆ ਜੇ ਉਰੇ ਵੀਰ ਜੇ ਬਾਈਕ ਬੁਇਕ ਰੈਂਟ 'ਤੇ ਲੈਣੀ ਹੋਵੇ ਮਿਲ ਜਾਂਦੀ ਉਹ ਵੀ ਠੀਕ ਹੈ ਜੀ ਉਰੇ ਮੌ ਮੌਸਮ ਵਧੀਆ ਰਹਿੰਦਾ ਮਤਲਬ ਉਰੇ ਦਾ ਜੀ ਠੀਕ ਹੈ ਚਲੋ ਠੀਕ ਹੈ ਵੀਰ